ਪੰਜਾਬ ਵਿੱਚ ਔਰਤਾਂ ਕਮੀਜ਼ ਸਲਵਾਰ ਅਤੇ ਸਿਰ 'ਤੇ ਦੁਪੱਟਾ ਲੈਂਦੀਆਂ ਹਨ ਅਤੇ ਨਾਲ ਉਹਨਾਂ ਦੇ ਫੁਲਕਾਰੀ ਹੁੰਦੀ ਹੈ ਪੈਰਾਂ ਵਿੱਚ ਪੰਜਾਬੀ ਜੁੱਤੀ ਹੁੰਦੀ ਹੈ ਅਤੇ ਜੇ ਗਹਿਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਸਿਰ 'ਤੇ ਸੱਗੀ ਫੁੱਲ ਹੁੰਦਾ ਹੈ ਕੰਨਾਂ ਵਿੱਚ ਕਾਂਟੇ ਹੁੰਦੇ ਹਨ ਗਲੇ ਵਿੱਚ ਸੋਨੇ ਦਾ ਜਾਂ ਚਾਂਦੀ ਦਾ ਹਾਰ ਹੁੰਦਾ ਹੈ ਹੱਥਾਂ ਵਿੱਚ ਚੂੜੀਆਂ ਹੁੰਦੀਆਂ ਹਨ ਅਤੇ ਮਰਦਾਂ ਨੇ ਕੁੜਤਾ ਅਤੇ ਚਾਦਰਾ ਪਾਇਆ ਹੁੰਦਾ ਹੈ ਸਿਰ ਅਤੇ ਤੁਰਲੇਦਾਰ ਪੱਗ ਹੁੰਦੀ ਹੈ ਗਲ ਵਿੱਚ ਕੈਂਠਾ ਹੁੰਦਾ ਹੈ ਅਤੇ ਪੈਰਾਂ ਵਿੱਚ ਖੁਸਾ ਹੁੰਦਾ ਹੈ ਇੱਥੇ ਪੰਜਾਬ ਵਿੱਚ ਬਹੁਤ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਜਿਵੇਂ ਕਿ ਇੱਥੇ ਬਹੁਤ ਸਾਰੇ ਮੁਸਲਮਾਨ ਵੀ ਰਹਿੰਦੇ ਹਨ ਉਹਨਾਂ ਨੇ ਵੀ ਕੁੜਤਾ ਪਜਾ ਜੈਂਟਸ ਨੇ ਕੁੜਤਾ ਪਜਾਮਾ ਪਾਇਆ ਹੁੰਦਾ ਹੈ ਅਤੇ ਲੇਡੀਜ਼ ਨੇ ਬੁਰਕਾ ਪਾਇਆ ਹੁੰਦਾ ਹੈ ਇਸੇ ਤਰ੍ਹਾਂ ਹੀ ਮਤਲਬ